ਹਾਂਜੀ ਅਤੇ ਸਾਡੇ ਘਰ ਮੇਰੇ ਪੇਰੈਂਟਸ ਦੇ ਵਿਆਹ ਦੀਆਂ ਐਲਬਮ ਅਤੇ ਕੁਝ ਮੇਰੀਆਂ ਬਚਪਨ ਦੀਆਂ ਅਤੇ ਕੁਝ ਮੇਰੇ ਸਕੂਲ ਦੇ ਸਲਾਨਾ ਸਮਾਗਮਾਂ ਦੀਆਂ ਜਿਹੜੀਆਂ ਫੋਟੋਆਂ ਪੁਰਾਣੀਆਂ ਹਾਰਡ ਕਾਪੀ ਦੇ ਰੂਪ 'ਚ ਪਈਆਂ ਅਤੇ ਇਹਨਾਂ ਨੂੰ ਦੇਖ ਕੇ ਜਿਹੜੀਆਂ ਸਾਡੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਪੁਰਾਣੀਆਂ ਫੋਟੋਆਂ ਸੀ ਉਹਨਾਂ 'ਚ ਜ਼ਿਆਦਾ ਭਾਵਨਾਤਮਕ ਮੁੱਲ ਹੁੰਦਾ ਸੀ ਜਦ ਅਕਸਰ ਹੀ ਜਦੋਂ ਅਸੀਂ ਆਪਣੇ ਘਰ ਵਿੱਚ ਲੱਗੀ ਨਾ ਹਾਰਡ ਕਾਪੀ ਫੋਟੋ ਨੂੰ ਦੇਖਦੇ ਹਾਂ ਤਾਂ ਸਾਡੇ ਦਿਮਾਗ 'ਚੋਂ ਉਸ ਟਾਈਮ ਦਾ ਸਾਰਾ ਸੀਨ ਆ ਜਾਂਦਾ ਸੀ ਇੱਕ ਤਰੀਕੇ ਨਾਲ ਉਸ ਸਮੇਂ ਦੇ ਵਿੱਚ ਹੀ ਪਹੁੰਚ ਜਾਂਦੇ ਆ ਅੱਜ ਕੱਲ੍ਹ ਦੀਆਂ ਜਿਹੜੀਆਂ ਡਿਜੀਟਲ ਫੋਟੋਆਂ ਭਾਵੇਂ ਸਾਨੂੰ ਮਿੰਟਾਂ ਸਕਿੰਟਾਂ 'ਚ ਮਿਲ ਜਾਂਦੀਆਂ ਪਰ ਇਹਨਾਂ ਦਾ ਜਾਦੂ ਵੀ ਉਸੇ ਹਿਸਾਬ ਨਾਲ ਸਿਰ ਥੋੜ੍ਹਾ ਜਿਹਾ ਟਾਈਮ ਹੀ ਰਹਿੰਦਾ ਅਤੇ ਪਰ ਜਿਹੜੀਆਂ ਹੁੰਦੀਆਂ ਸੀ ਪੁਰਾਣੀਆਂ ਹਾਰਡ ਕਾਪੀਆਂ ਹੁੰਦੀਆਂ ਸੀ ਉਹਨਾਂ ਨੂੰ ਅਸੀਂ ਉਸ ਪੂਰੀ ਜ਼ਿੰਦਗੀ ਸਾਡੇ ਮਤਲਬ ਦਿਮਾਗ ਦੇ ਵਿੱਚ ਜਾਂ ਸਾਡੇ ਸਾਹਮਣੇ ਰਹਿੰਦੀਆਂ ਸੀ ਅਤੇ ਅਸੀਂ ਰੋਜ਼ਾਨਾ ਹੁਣ ਅੱਜ ਕੱਲ੍ਹ ਆਪਣੀ ਫੋਨ ਦੇ ਵਿੱਚ ਹੀ ਕਹਿੰਦੇ ਡਿਜੀਟਲ ਕੈਮਰੇ ਆ ਗਏ ਅਸੀਂ ਕਿੰਨੀਆਂ ਫੋਟੋਆਂ ਕਲਿੱਕ ਕਰ ਲੈਂਦੇ ਆ ਹੈ ਨਾ ਅਗਲੇ ਦਿਨ ਸਾਨੂੰ ਜਾਂ ਥੋੜ੍ਹੇ ਦਿਨਾਂ ਬਾਅਦ ਅਸੀਂ ਉਹ ਫੋਟੋਆਂ ਨੂੰ ਭੁੱਲ ਜਾਂਦੇ ਆ ਅਸੀਂ ਨਵੀਆਂ ਫੋਟੋਆਂ ਕਲਿੱਕ ਕਰ ਲੈਨੇ ਹਾਂ ਅਤੇ ਇਸ ਤੋਂ ਇਲਾਵਾ ਜਿਹੜੀਆਂ ਪੁਰਾਣੀਆਂ ਫੋਟੋਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਇੱਕ ਨੈਚੁਰਲ ਜਿਹੜੀ ਖੂਬਸੂਰਤੀ ਹੁੰਦੀ ਸੀਗੀ ਉਹਨਾਂ ਪਰ ਅੱਜ ਕੱਲ੍ਹ ਡਿਜੀਟਲ ਫੋਟੋਆਂ ਇਹਦੇ ਵਿੱਚ ਕਿੰਨੇ ਹੀ ਅਸੀਂ ਫਿਲਟਰ ਲਾ ਕੇ ਨਾ ਐਡਿਟ ਕਰਕੇ ਨਾ ਵੱਖ ਵੱਖ ਸੋਫਟਵੇਅਰਾਂ ਦੀ ਮਦਦ ਨਾਲ ਇਹਨਾਂ ਦੇ ਜਿਹੜੇ ਨੈਚੁਰਲ ਖੂਬਸੂਰਤੀ ਸੀ ਫੋਟੋਆਂ ਦੀ ਜਾਂ ਕਿਸੇ ਵੀ ਇਨਸਾਨ ਦੀ ਜਾਂ ਕਿਸੇ ਲੋਕੇਸ਼ਨ ਦੀ ਉਹਨੂੰ ਖਤਮ ਕਰ ਦਿੱਤਾ ਗਾ ਧੰਨਵਾਦ ਜੀ